ਮੈਂ ਵਿਜੇ ਗੁਰਦਾਸਪੁਰ ਜਿਲੇ ਵਿੱਚ ਰਹਿੰਦਾ ਹਾਂ ਮੈਂ ਅੱਜ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਉਮਰ ਅਠਾਰਾਂ ਸਾਲ ਤੋਂ ਦੋ ਚਾਰ ਦਿਨ ਉੱਪਰ ਹੋ ਗਈ ਹੈ ਤੇ ਮੈਂ ਚਾਹੁੰਦਾ ਹਾਂ ਕਿ ਮੈਂ ਵੀ ਪੈਨ ਕਾਰਡ ਲਈ ਅਪਲਾਈ ਕਰਾਂ ਇਸ ਵਾਸਤੇ ਮੈਂ ਆਪਣੇ ਪਰਿਵਾਰ ਦੇ ਮੈਂਬਰ ਨਾਲ ਸਲਾਹ ਕੀਤੀ ਤੇ ਉਸ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਸਭ ਤੋਂ ਪਹਿਲਾਂ ਇੱਕ ਕੈਫੇ ਵਿੱਚ ਜਾ ਕੇ ਪੈਨ ਕਾਰਡ ਅਪਲਾਈ ਕਰੋ ਜਿਸਦੀ ਥੋੜੀ ਜਿਹੀ ਫੀਸ ਹੋਵੇਗੀ ਜਦੋਂ ਉਹ ਫੀਸ ਭਰ ਕੇ ਤੁਸੀਂ ਅਪਲਾਈ ਕਰ ਦੇਵੋਗੇ ਤਾਂ ਤੁਹਾਡਾ ਪੈਨ ਕਾਰਡ ਅਪਲਾਈ ਹੋ ਜਾਵੇਗਾ ਮੈਂ ਉਸ ਲਈ ਆਪਣਾ ਐਡਰੈਸ ਪਰੂਫ ਵੀ ਨਾਲ ਦਿੱਤਾ ਜਾਂ ਉਹਨਾਂ ਨੇ ਮੈਨੂੰ ਦੇਣ ਲਈ ਕਿਹਾ ਇਸ ਲਈ ਮੈਂ ਬੜੇ ਹੀ ਵਧੀਆ ਤਰੀਕੇ ਨਾਲ ਆਪਣਾ ਫਾਰਮ ਲਿਆ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਇਹ ਅੱਜ ਕੱਲ ਘਰ ਬੈਠੇ ਹੀ ਆਨਲਾਈਨ ਅਪਲਾਈ ਕਰ ਸਕਦੇ ਹੋ ਇਸ ਲਈ ਓਟੀਪੀ ਵੀ ਆਉਂਦਾ ਹੈ ਜਾਂ ਇਸ ਲਈ ਤੁਹਾਡਾ ਸਾਰਾ ਪਤਾ ਅਤੇ ਫੋਨ ਨੰਬਰ ਵਗੈਰਾ ਵਿੱਚ ਲਿਖਿਆ ਭਰਿਆ ਜਾਂਦਾ ਹੈ ਇਸ ਲਈ ਪੈਨ ਕਾਰਡ ਜਦੋਂ ਮੇਰਾ ਬਣ ਜਾਵੇਗਾ ਤਾਂ ਮੈਂ ਇਸਦੀ ਇੱਕ ਤਾਂ ਸ਼ਨਾਖਤ ਦੇ ਤੌਰ ਤੇ ਵਰਤੋਂ ਕਰ ਸਕਦਾ ਹਾਂ ਦੂਜਾ ਮੈਂ ਰਿਟਰਨ ਭਰ ਸਕਦਾ ਹਾਂ ਜੋ ਕਿ ਸਰਕਾਰ ਦੇ ਨਿਯਮਾਂ ਵਿੱਚ ਜੋ ਵੀ ਕਰ ਜਾਂ ਟੈਕਸ ਹੁੰਦਾ ਹੈ ਉਸ ਦੀ ਅਦਾਇਗੀ ਸਮੇਂ ਸਿਰ ਕਰ ਲਵਾਂਗਾ ਇਸ ਤਰ੍ਹਾਂ ਮੈਂ ਪੈਨ ਕਾਰਡ ਦੀ ਅਪਲਾਈ ਕੀਤਾ ਜੋ ਕੀ ਮੇਰਾ ਪੈਨ ਕਾਰਡ ਬਣ ਜਾਵੇਗਾ ਧੰਨਵਾਦ